ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵੱਖ ਵੱਖ ਤਰ੍ਹਾਂ ਦੇ ਬਰਤਨ ਬਣਾਏ ਜਾਂਦੇ ਹਨ ਅਤੇ ਪੇਂਟਿੰਗ ਕੀਤੀ ਜਾਂਦੀ ਹੈ ਬਰਤਨਾਂ ਦੇ ਉੱਪਰ ਕੱਚੇ ਬਰਤਨ ਬਣਾਏ ਜਾਂਦੇ ਹਨ 'ਤੇ ਕੱਚੇ ਬਰਤਨਾਂ ਵਿੱਚ ਘੜੇ ਝਾਵੇਂ ਗੋਲਕਾਂ ਇੱਦਾਂ ਦੇ ਕਈ ਬਰਤਨ ਬਣਾਏ ਜਾਂਦੇ ਹਨ ਅਤੇ ਹੋਰ ਵੀ ਵਧੀਆ ਤਰੀਕੇ ਦੇ ਨਾਲ਼ ਕਲਾ ਕੀਤੀ ਜਾਂਦੀ ਹੈ ਅਤੇ ਰੋਪੜ ਜ਼ਿਲ੍ਹੇ ਦੇ ਵਿੱਚ ਹੋਰ ਸ਼ਹਿਰਾਂ ਨਾਲ ਤੋਂ ਵੱਖਰੇ ਹੀ ਕਲਾਕਾਰ ਹਨ ਜੋ ਕਿ ਬਹੁਤ ਹੀ ਵਧੀਆ ਕਲਾ ਦੇ ਰੂਪ ਵਿੱਚ ਪੇਂਟਿੰਗ ਅਤੇ ਬਰਤਨ ਬਣਾਉਂਦੇ ਹਨ ਅਤੇ ਛਪਾਈ ਦਾ ਕੰਮ ਕਰਦੇ ਹਨ